ਮੈਂ ਤੁਹਾਨੂੰ ਰਨਿੰਗ ਦੇ ਫਾਇਦਿਆਂ ਬਾਰੇ ਜ਼ਰੂਰ ਦੱਸ ਸਕਦਾ ਹਾਂ ਨੰਬਰ ਇੱਕ ਸਰੀਰਿਕ ਸਿਹਤ ਰਨਿੰਗ ਕਰਨ ਨਾਲ ਦਿਲ ਦੀ ਸਿਹਤ ਸੁਧਰਦੀ ਹੈ ਵਜਨ ਘੱਟਦਾ ਹੈ ਹੱਡੀਆਂ ਮਜਬੂਤ ਹੁੰਦੀਆਂ ਹਨ ਅਤੇ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ ਨੰਬਰ ਦੋ ਮਾਨਸਿਕ ਸਿਹਤ ਰਨਿੰਗ ਕਰਨ ਨਾਲ ਤਨਾਅ ਘੱਟ ਹੁੰਦਾ ਹੈ ਮੂਡ ਬਿਹਤਰ ਹੁੰਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ ਤਿੰਨ ਸਮੁੱਚੀ ਤੰਦਰੁਸਤੀ ਰਨਿੰਗ ਕਰਨ ਨਾਲ ਸਮੁੱਚੀ ਤੰਦਰੁਸਤੀ ਵਿੱਚ ਸੁਧਾਰ ਹੁੰਦਾ ਹੈ ਰੇਲਿੰਗ ਅਤੇ ਸਪਿਟ ਅੰਤਰ ਦੌਰਾਨ ਵਰਗੀਆਂ ਖਾਸ ਕਿਸਮ ਦੀਆਂ ਦੌੜ੍ਹਾਂ ਦੇ ਆਪਣੇ ਆਪਣੇ ਫਾਇਦੇ ਹੁੰਦੇ ਹਨ ਜਿਵੇਂ ਕਿ ਰੇਲਿੰਗ ਰਨਿੰਗ ਇਹ ਇੱਕ ਖਾਸ ਕਿਸਮ ਦੀ ਦੌੜ ਹੈ ਜੋ ਕੁਦਰਤੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਇਹ ਸਰੀਰ ਨੂੰ ਵਧੇਰੇ ਚੁਣੌਤੀਆਂ ਦਿੰਦੀ ਹੈ ਅਤੇ ਸੰਤੁਲਨ ਅਤੇ ਤਾਲਮੇਲ ਵਿੱਚ ਸੁਧਾਰ ਕਰਦੀ ਹੈ ਨੰਬਰ ਦੋ ਸਪਿਟ ਅੰਤਰਿਨ ਦੌੜ ਇਹ ਇੱਕ ਕਿਸਮ ਦੀ ਦੌੜ ਹੈ ਵਿੱਚ ਤੇਜ਼ ਅਤੇ ਹੌਲੀ ਦੌੜ ਨੂੰ ਬਦਲਿਆ ਜਾ ਸਕਦਾ ਹੈ ਇਹ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹੈ ਕੈਲਰੀ ਬਰੋਨ ਕਰਨ ਵਿੱਚ ਮਦਦ ਕਰਦੀ ਹੈ